ਹਰ ਪ੍ਰਦੇਸ਼ ਦੀ ਆਪਣੀ ਇੱਕ ਕਲਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ ਗੱਲ ਕਰੀਏ ਪੰਜਾਬ ਦੇ ਖਿਲਖਿਲਾਉਂਦੇ ਖੇਤਾਂ ਦੀ ਕਣਕਾਂ ਦੀ ਅਤੇ ਇਸ ਕਣਕਾਂ ਦੇ ਰੰਗਾਂ ਦੀ ਗੱਲ ਕਰੀਏ ਫੁਲਕਾਰੀ ਦੀ ਭਾਵੇਂ ਦਬਕਾ ਵਰਗ ਦੀ ਸ਼ਿਲਪਕਾਰੀ ਦੀ ਆਪਾਂ ਇਨ੍ਹਾਂ ਸਾਰੀਆਂ ਸੱਭਿਆਚਾਰ ਆਪਾਂ ਇਸ ਕਲਾ ਨੂੰ ਸੰਭਾਲਦੇ ਹੋਏ ਇਹਨੂੰ ਸ਼ੌਂਕੀਆ ਤੌਰ 'ਤੇ ਨਹੀਂ ਆਪਾਂ ਇਹਨੂੰ ਇੱਕ ਨੌਕਰੀ ਦੇ ਤੌਰ 'ਤੇ ਵੀ ਲੈ ਸਕਦੇ ਹਾਂ ਆਪਾਂ ਇਨ੍ਹਾਂ ਰੰਗਾਂ ਦੇ ਦੁਆਰਾ ਜੋ ਵੀ ਚਿੱਤਰਕਾਰੀ ਕਰਦੇ ਹਾਂ ਆਪਣੇ ਪੰਜਾਬ ਨੂੰ ਦਰਸਾਉਂਦੇ ਹਾਂ ਪੰਜਾਬ ਦੇ ਵਿੱਚ ਹੋਣ ਵਾਲੇ ਆਪਣੇ ਪੁਰਾਣੇ ਸੱਭਿਆਚਾਰ ਨੂੰ ਜਿੰਦਾ ਰੱਖ ਸਕਦੇ ਹਾਂ ਤਾਂ ਕਿ ਆਉਣ ਵਾਲਾ ਸਮਾਂ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਇਹਨਾਂ ਆਪਣੀ ਕਲਾ ਦੇ ਦੁਆਰਾ ਜੋ ਆਪਾਂ ਚੀਜ਼ਾਂ ਬਣਾ ਕੇ ਸੰਭਾਲੀਆਂ ਹੋਣਗੀਆਂ ਉਹਨਾਂ ਨੂੰ ਵੇਖ ਸਕੇਗਾ ਅਤੇ ਸਮਝ ਸਕੇਗਾ ਕਿ ਸਾਡਾ ਪੰਜਾਬ ਕੀ ਹੈ